ਸਾਡੇ ਪਿੰਡ ਵਿੱਚ ਪਾਣੀ ਦੇ ਕਈ ਤਰ੍ਹਾਂ ਦੇ ਸਰੋਤ ਹਨ ਜਿਵੇਂ ਕਿ ਸਾਡੇ ਪਿੰਡ ਦੇ ਸਾਰੇ ਘਰਾਂ ਵਿੱਚ ਪਾਣੀ ਆਉਂਦਾ ਹੈ ਜੋ ਕਿ ਸਰਕਾਰ ਵੱਲੋਂ ਕੀਤਾ ਇੱਕ ਵਧੀਆ ਉਪਰਾਲਾ ਹੈ ਇਹ ਸਰਕਾਰ ਵੱਲੋਂ ਕੀਤਾ ਗਿਆ ਬਹੁਤ ਹੀ ਪੁਰਾਣਾ ਉਪਰਾਲਾ ਹੈ ਜਿਸ ਨਾਲ ਕਿ ਅੱਜ ਸਾਨੂੰ ਬਹੁਤ ਹੀ ਲਾਭ ਹੋ ਰਿਹਾ ਹੈ ਅਤੇ ਸਾਡੇ ਪਿੰਡ ਵਿੱਚ ਭਾਖੜਾ ਨਦੀ ਦਾ ਪਾਣੀ ਹਰ ਘਰ ਵਿੱਚ ਟੈਂਕੀਆਂ ਦੁਆਰਾ ਸਪਲਾਈ ਕੀਤਾ ਜਾਂਦਾ ਹੈ ਜੋ ਕਿ ਪਾਣੀ ਦਾ ਸਭ ਤੋਂ ਵਧੀਆ ਸਰੋਤ ਹੈ ਪਾਣੀ ਦਾ ਇੱਕ ਹੋਰ ਸਰੋਤ ਹੈ ਇਹ ਹੈ ਕਿ ਮਿੱਟੀ ਦੀ ਡੂੰਘੀ ਪਟਾਈ ਪੁੱਟ ਕੇ ਕੁਝ ਸਮਰਸੀਬਲ ਮਸ਼ੀਨਾਂ ਫਿੱਟ ਕੀਤੀਆਂ ਜਾਂਦੀਆਂ ਹਨ ਜਿਹਨਾਂ ਨਾਲ ਸਾਫ ਅਤੇ ਸ਼ੁੱਧ ਪਾਣੀ ਸਾਨੂੰ ਪ੍ਰਾਪਤ ਹੁੰਦਾ ਹੈ ਇਹ ਮਸ਼ੀਨਾਂ ਨਾਲ ਇੱਦਾਂ ਦਾ ਕੁਛ ਨਹੀ ਕਿ ਸਾਡੇ ਕੋਲ ਸਾਫ ਪਾਣੀ ਨਹੀਂ ਆਏਗਾ ਪਰੰਤੂ ਇਹ ਮਸ਼ੀਨਾਂ ਪਾਣੀ ਨੂੰ ਸਾਫ ਕਰ ਦਿੰਦੀਆਂ ਹਨ ਅਤੇ ਸਾਰੇ ਘਰਾਂ ਵਿੱਚ ਸਾਫ ਅਤੇ ਸ਼ੁੱਧ ਪਾਣੀ ਪਹੁੰਚਾਇਆ ਜਾਂਦਾ ਹੈ ਸਾਡੇ ਪਿੰਡ ਵਿੱਚ ਪਾਣੀ ਦੇ ਵੱਖ ਵੱਖ ਸਰੋਤ ਕਾਰਨ ਕਿਸੇ ਨੂੰ ਵੀ ਪਾਣੀ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਿਸ ਕਾਰਨ ਪਾਣੀ ਦੀ ਕੋਈ ਕਮੀ ਨਹੀਂ ਹੈ ਅਤੇ ਸਭ ਪਾਣੀ ਦਾ ਲਾਭ ਉਠਾ ਰਹੇ ਹਨ ਅਤੇ ਇਹ ਸਾਰੇ ਪਾਣੀ ਦੇ ਸਰੋਤ ਪੂਰੇ ਸਾਲ ਲਈ ਉਪਲਬਧ ਹਨ